ਮੌਸਮ ਬਾਈਕਿੰਗ ਨੂੰ ਕਿਵੇਂ ਪ੍ਰਭਾਵ ਕਰਦਾ ਹੈ ਜਿਵੇਂ ਕਿ ਹੁਣ ਆਪਾਂ ਜਦੋਂ ਸਰਦੀਆਂ 'ਚ ਜਾਈਦਾ ਅਤੇ ਸਾਨੂੰ ਕੱਪੜੇ ਜ਼ਿਆਦਾ ਪਾਉਣੇ ਪੈਂਦੇ ਨੇ ਅਤੇ ਤਾਂ ਕਿ ਜਦੋਂ ਆਪਾਂ ਬਾਈਕਿੰਗ ਕਰਨ ਜਾਈਏ ਤਾਂ ਆਪਾਂ ਮਤਲਬ ਓਵਿਅਸ ਆਪਾਂ ਬਾਈਕ ਤੇਜ਼ ਚਲਾਵਾਂਗੇ ਅਤੇ ਉਹਦੇ ਲਈ ਸਾਨੂੰ ਠੰਢ ਨਾ ਲੱਗ ਜਾਏ ਜਾਂ ਸਾਡੀ ਤਬੀਅਤ ਨਾ ਖਰਾਬ ਹੋ ਜਾਏ ਤਾਂ ਸਾਨੂੰ ਉਸ ਲਈ ਕੱਪੜੇ ਥੋੜ੍ਹੇ ਅਤੇ ਆਪਣੀ ਜਿਹੜੀ ਮੈਡੀਕਲ ਕਿੱਟ ਆ ਉਹ ਨਾਲ ਲੈ ਕੇ ਜਾਣਾ ਪੈਂਦਾ ਔਰ ਜਿਹੜਾ ਸਭ ਤੋਂ ਮਜ਼ਾ ਜਿਹਨੂੰ ਆਪਾਂ ਕਹਿ ਲਈਏ ਕਿ ਬਾਈਕਿੰਗ ਕਰਨ ਦਾ ਆਉਂਦਾ ਹੈ ਉਹ ਸਰਦੀਆਂ ਵਿੱਚ ਹੀ ਆਉਂਦਾ ਹੈ ਕਿ ਆਪਾਂ ਸਰਦੀਆਂ ਵਿੱਚ ਮੇਰੇ ਜੋ ਮੈਂ ਸੋਚਦੀ ਕਿ ਸਰਦੀਆਂ ਵਿੱਚ ਜ਼ਿਆਦਾ ਆਉਂਦਾ ਆਪਾਂ ਪਹਾੜਾਂ 'ਤੇ ਘੁੰਮ ਕੇ ਆਉਂਦੇ ਹਾਂ ਸਰਦੀਆਂ ਦੇ ਵਿੱਚ ਅਤੇ ਪਹਾੜਾਂ 'ਚ ਜਾਈਦਾ ਆਪਾਂ ਅਤੇ ਬਾਕੀ ਜਿਹੜਾ ਗਰਮੀਆਂ ਦੇ ਮੌਸਮ ਦੇ ਆਪਾਂ ਗੱਲ ਕਰੀਏ ਤਾਂ ਗਰਮੀਆਂ ਦੇ ਮੌਸਮ 'ਚ ਵੀ ਜ਼ਿਆਦਾ ਫਰਕ ਨਹੀਂ ਪੈਂਦਾ ਉਹਦੇ 'ਚ ਵੀ ਕਾਫੀ ਹੁੰਦਾ ਬਟ ਉਹਦੇ 'ਚ ਇਹ ਕਿ ਸਾਨੂੰ ਨਾ ਥੋੜ੍ਹੀ ਜਦੋਂ ਆਪਾਂ ਕਹਿ ਦਈਏ ਕਿ ਥੋੜ੍ਹੀ ਜ਼ਿਆਦਾ ਨਾਲ ਲੈ ਕੇ ਤੁਰਨੀ ਪੈਂਦੀ ਹੈ ਕਿ ਬਾਈਕ ਕਿਤੇ ਗਰਮ ਨਾ ਹੋ ਜਾਏ ਤਾਂ ਕਿ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਵੈਸੇ ਮਤਲਬ ਦੋਨਾਂ ਮਜ਼ਾ ਆਉਂਦਾ ਦੋਨਾਂ ਮੌਸਮਾਂ 'ਚ ਮਜ਼ਾ ਆਉਂਦਾ ਇੱਕ ਬਾਰਿਸ਼ ਦੇ ਮੌਸਮ 'ਚ ਸਾਨੂੰ ਥੋੜ੍ਹਾ ਘੱਟ ਮਤਲਬ ਅਵੋਇਡ ਕਰਨਾ ਚਾਹੀਦਾ ਬਾਈਕਿੰਗ ਨੂੰ ਧੰਨਵਾਦ